ਮੇਰੇ ਕੋਲ ਪਹਿਲਾਂ ਨੋਕੀਆ ਦਾ ਬਟਨਾਂ ਵਾਲਾ ਫੋਨ ਸੀ ਜਿਸ ਵਿੱਚ ਸਿਰਫ ਇੰਨੀ ਕੁ ਹੀ ਉਪਲੱਬਧਤਾ ਸੀ ਕਿ ਅਸੀਂ ਕਿਸੇ ਨੂੰ ਫੋਨ ਕਰ ਸਕਦੇ ਸੀ ਅਤੇ ਕਿਸੇ ਦਾ ਫੋਨ ਸਾਨੂੰ ਆ ਸਕਦਾ ਸੀ ਜਾਂ ਫਿਰ ਉਸ ਤੋਂ ਵੱਧ

ਜਿਹਦੇ ਨਾਲ ਸਾਨੂੰ ਕਾਫ਼ੀ ਬੈਨੀਫਿਟ ਹੋ ਗਿਆ ਉਹਨਾਂ ਦੇ ਵਿੱਚ ਸਮਾਰਟ ਫੋਨ ਦੇ ਵਿੱਚ ਵਟਸਐਪ ਦੀ ਟੈਕਨੋਲੋਜੀ ਆ ਗਈ ਜਿਹਦੇ ਵਿੱਚ ਆਪਾਂ ਘਰ ਬਹਿ ਕੇ ਵੀਡੀਓ ਕਾਲ ਕਰ ਸਕਦੇ ਹਾਂ ਕਿਸੇ ਨੂੰ ਈਮੇਲ ਸੈਂਡ ਕਰ ਸਕਦੇ ਕੋਈ ਕਮਰਸ਼ੀਅਲ ਕੰਮ ਕਰਨਾ ਉਹ ਵੀ ਕਰ ਸਕਦੇ ਹਾਂ ਹਰ ਕੰਮ ਦੀ ਸੁਵਿਧਾ ਹੋ ਗਈ ਜਿਹਦੇ ਨਾਲ ਟੈਕਨੋਲੋਜੀ ਵਿੱਚ ਬਹੁਤ ਵਾਧਾ ਹੋਇਆ